ਪੰਜਾਬ ਦੇ ਲੋਕ ਬਹੁਤ ਧਾਰਮਕ ਅਤੇ ਆਪਣੇ ਸੱਭਿਆਚਾਰ ਨੂੰ ਪਿਆਰ ਅਤੇ ਪਸੰਦ ਕਰਦੇ ਹਨ ਉਹਨਾਂ ਦਾ ਆਪਣੇ ਧਰਮ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਕਿਉਂਕਿ ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਆਪੋ ਆਪਣੇ ਰੀਤੀ ਰਿਵਾਜ਼ ਅਤੇ ਸੱਭਿਆਚਾਰ ਹਨ ਉਹ ਆਪਣੇ ਧਰਮ ਦੇ ਬਹੁਤ ਪਰਪੱਕ ਹਨ ਪ੍ਰੰਤੂ ਸਤਿਕਾਰ ਹਰ ਇੱਕ ਧਰਮ ਦਾ ਕਰਦੇ ਹਨ ਅਤੇ ਸੱਭਿਆਚਾਰਕ ਮੇਲਿਆਂ ਵਿੱਚ ਸਾਰੇ ਹੀ ਇਕੱਠੇ ਆਉਂਦੇ ਹਨ ਅਤੇ ਮਨਾਉਂਦੇ ਹਨ ਇਸ ਦੇ ਨਾਲ਼ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਵੱਧਦੀ ਹੈ